ਪਿਛਲੇ ਸਮੇਂ ਭਾਵ ਕੁਛ ਸਾਲਾਂ ਤੋਂ ਡਾਂਸਿੰਗ ਵਿੱਚ ਬਹੁਤ ਬਦਲਾਅ ਆਇਆ ਹੈ ਕਿਉਂਕਿ ਉਹ ਡਾਂਸਿੰਗ ਵਿੱਚ ਵੱਖਰੇ ਵੱਖਰੇ ਵਿਦੇਸ਼ਾਂ ਤੋਂ ਲਏ ਅਤੇ ਹੁਣ ਉਹ ਵਿਦੇਸ਼ੀ ਨਾਚ ਨਾਲ ਹੀ ਜ਼ਿਆਦਾ ਪ੍ਰਚੱਲਿਤ ਹਨ ਪ੍ਰੰਤੂ ਪੁਰਾਣੇ ਨਾਚ ਦਾ ਵੱਖਰਾ ਹੀ ਅੰਦਾਜ ਸੀ ਜਿਵੇਂ ਕਿ ਪੰਜਾਬੀ ਡਾਂਸ 'ਚ ਲੁੱਡੀ ਸੰਮੀ ਕਿੱਕਲੀ ਭੰਗੜਾ ਗਿੱਦਾ ਮਲਵਈ ਗਿੱਧਾ ਝੂਮਰ ਆਦਿ ਜਿਹਨਾਂ ਨੂੰ ਸੁਣ ਕੇ ਦੇਖ ਕੇ ਲੋਕ ਬਹੁਤ ਆਨੰਦ ਮਾਣਦੇ ਸਨ ਅਤੇ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਅਤੇ ਉਸ ਦਾ ਦਿਨੋਂ ਦਿਨ ਜਿਹੜਾ ਗਾ ਉਹਦਾ ਵਿਕਾਸ ਹੈ ਜਿਹੜਾ ਭਾਵ ਉਹਨੂੰ ਕਰਨ ਦੇ ਵਿੱਚ ਪੱਧਰ ਹੈ ਜਿਹੜਾ ਉਹ ਵੱਧ ਰਿਹਾ ਹੈ ਅਤੇ ਇਸ ਦਾ ਜਿਹੜਾ ਇੱਕ ਹੋਰ ਨਵਾਂ ਰੂਪ ਆ ਜਿਵੇਂ ਕਿ ਅੰਤਰਰਾਸ਼ਟਰੀ ਪੱਧਰ 'ਤੇ ਵੀ ਇਸ ਡਾਂਸ ਨੂੰ ਬਹੁਤ ਵਧੀਆ ਤਰੀਕੇ ਕਰਵਾਇਆ ਜਾਂਦਾ ਹੈ ਭਾਵ ਜ਼ਿਆਦਾ ਤੋਂ ਜ਼ਿਆਦਾ ਪ੍ਰੋਗਰਾਮਾਂ ਵਿੱਚ ਇਸ ਡਾਂਸ ਨੂੰ ਕੀਤਾ ਜਾਂਦਾ ਹੈ